ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਸ਼ੋਪ ਤੋਂ ਲਾਸਟ ਮੰਥ ਨਾ ਕੁਝ ਬੁੱਕਸ ਵਗੈਰਾ ਔਡਰ ਕੀਤੀਆਂ ਸੀਗੀਆਂ ਅਤੇ ਜਿਹੜੀਆਂ ਤੁਸੀਂ ਮੈਨੂੰ ਬੁੱਕਸ ਭੇਜੀਆਂ ਨੇ ਉਹ ਮੈਂ ਕਿਸੇ ਹੋਰ ਬੱਚੇ ਦੇ ਲੀਏ ਔ ਔਡਰ ਕੀਤੀਆਂ ਨੇ ਤਾਂ ਤੁਹਾਡੀਆਂ ਬੁੱਕਸ ਨੇ ਉਹ ਬੱਚੇ ਨੂੰ ਬਹੁਤ ਪਸੰਦ ਆਈਆਂ ਤੁਹਾਡੀ ਬੁੱਕਸ ਦੀ ਕੋਆਲਟੀ ਮੈਂ ਆਪ ਵੀ ਚੈੱਕ ਕੀਤੀ ਸੀ ਬਹੁਤ ਜ਼ਿਆਦਾ ਵਧੀਆ ਸੀ ਪੇਜਿਸ ਵੀ ਬਹੁਤ ਵਧੀਆ ਸੀ ਐਨ ਕੋਈ ਵੀ ਉਹਦੇ ਵਿੱਚ ਕੋਈ ਪੇਜ ਵਗੈਰਾ ਫਟਿਆ ਹੋਇਆ ਨਹੀਂ ਸੀ ਚੰਗੀ ਤਰ੍ਹਾਂ ਬਾਈਨਿੰਗ ਹੋ ਰੱਖੀ ਸੀ ਬਹੁਤ ਵਧੀਆ ਕੋਆਲਟੀ ਦੀਆਂ ਬੁੱਕਸ ਸੀ ਅਤੇ ਔਥਰ ਦਾ ਮੈਨੂੰ ਕਲੈਰਟੀ ਨਹੀਂ ਸੀ ਫਿਰ ਵੀ ਤੁਸੀਂ ਜਿਹੜਾ ਔਥਰ ਹੈ ਆਪਣੇ ਵੱਲੋਂ ਤੁਸੀਂ ਆਪ ਸਿਲੈਕਟ ਕਰਕੇ ਔਥਰ ਭੇਜਿਆ ਅਤੇ ਉਹ ਔਥਰ ਵੀ ਜਿਹੜੀ ਰਾਈਟਿੰਗਸ ਹੈ ਉਹਨਾਂ ਦੀ ਉਹ ਵੀ ਬਹੁਤ ਜ਼ਿਆਦਾ ਵਧੀਆ ਸੀ ਅਤੇ ਬੱਚਿਆਂ ਨੂੰ ਵੀ ਉਹ ਬੁੱਕਸ ਹੈ ਜਿਹੜੀਆਂ ਬਹੁਤ ਪਸੰਦ ਆਈਆਂ ਅਤੇ ਬਹੁਤ ਹੀ ਜ਼ਿਆਦਾ ਉਹਨਾਂ ਦੇ ਲੀਏ ਜਿਹੜੀਆਂ ਕਿਤਾਬਾਂ ਏ ਮੱਦਦਗਾਰ ਵੀ ਰਹੀਆਂ ਉਹਨਾਂ ਨੇ ਆਪਣੀ ਜਿਹੜੀ ਅੱਗੇ ਪੇਪਰ ਦੀ ਤਿਆਰੀ ਸੀ ਇਹਨਾਂ ਬੁੱਕਸ ਦੇ ਵਿੱਚੋਂ ਹੀ ਕੀਤੀ